ਮੈਂ ਇਸਦੇ ਵਿੱਚ ਆਪਣੇ ਸਭ ਤੋਂ ਪਹਿਲੇ ਪ੍ਰੋਡਕਟ ਦੀ ਗੱਲ ਕਰਨਾ ਚਾਹੁੰਦੀ ਹਾਂ ਜੋ ਮੈਂ ਔਨਲਾਈਨ ਮੰਗਵਾਇਆ ਸੀ ਅਤੇ ਉਹ ਔਨਲਾਈਨ ਜੋ ਮੰਗਵਾਇਆ ਸੀ ਉਹ ਮੈਂ ਪਹਿਲੀ ਵਾਰ ਮੰਗਵਾਇਆ ਸੀ ਉਹ ਸੀ ਰਿਸਟ ਵੋਚ ਜੋ ਕਿ ਐਪਲ ਦੀ ਸੀ ਅਤੇ ਮੈਨੂੰ ਪਹਿਲਾਂ ਔਨਲਾਈਨ ਮੰਗਵਾਉਣਾ ਨਹੀਂ ਸੀ ਆਉਂਦਾ ਫਿਰ ਮੇਰੇ ਦੋਸਤਾਂ ਨੇ ਮੈਨੂੰ ਸਮਝਾਇਆ ਅਤੇ ਸਟੈਪ ਬਾਏ ਸਟੈਪ ਮੈਂ ਉਹ ਸਿੱਖੀ ਅਤੇ ਫਿਰ ਉਸ ਤੋਂ ਬਾਅਦ ਮੈਂ ਆਪਣੇ ਸਾਰੇ ਪ੍ਰੋਡਕਟਸ ਖੁਦ ਮੰਗਵਾਏ ਅਤੇ ਹੁਣ ਥੋੜ੍ਹਾ ਜਿਹਾ ਮੈਂ ਰਿਸਟ ਵੋਚ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਰਿਸਟ ਵੋਚ ਜੋ ਐਪਲ ਦੀ ਸੀ ਅਤੇ ਜਿਹਦੇ ਕਰਕੇ ਮੈਨੂੰ ਫੋਨ ਦੀ ਵੀ ਜ਼ਰੂਰਤ ਨਹੀਂ ਪੈਂਦੀ ਅਤੇ ਮੈਂ ਹਰ ਜਗ੍ਹਾ 'ਤੇ ਰਿਸਟ ਵੋਚ ਜੋ ਕਿ ਐਪਲ ਦੀ ਸੀ ਉਸਨੂੰ ਮੈਂ ਆਪਣੇ ਬਾਂਹ 'ਤੇ ਪਾ ਕੇ ਕਿਤੇ ਵੀ ਜਾ ਸਕਦੀ ਸੀ ਅਤੇ ਇੱਕ ਹਿਸਾਬ ਦਾ ਉਹ ਇੱਕ ਫੋਨ ਹੀ ਸੀ ਅਤੇ ਫੋਨ ਅਸੀਂ ਉਸਦੇ ਵਿੱਚ ਅਸੀਂ ਫੋਨ ਵੀ ਚੱਕ ਸਕਦੇ ਹਾਂ ਅਤੇ ਹਾਰਟ ਰੇਟ ਸਾਈਕਲੀਨ ਤੁਰਨ ਵਾਲੇ ਸਟੈਪਸ ਸਾਰਾ ਕੁਝ ਅਸੀਂ ਉਸ ਵੋਚ ਵਿੱਚ ਕਰ ਸਕਦੇ ਹਾਂ ਅਤੇ ਉਸਦੇ ਹੋਰ ਵੀ ਕਾਫੀ ਵਰਤੋਂ ਕੀਤੀ ਜਾ ਸਕਦੀ ਹੈ